ਹਾਂ ਮੈਂ ਰਲੇਅ ਦੌੜ ਚਲਾਈ ਆ ਉਸ ਵਿੱਚ ਮੈਨੂੰ ਉਸ ਟਾਈਮ ਪਤਾ ਲੱਗਾ ਜਦੋਂ ਮੈਂ ਸਕੂਲ ਟਾਈਮ ਹੁੰਦਾ ਸੀ ਅਤੇ ਸਕੂਲ ਵਿੱਚ ਵੀ ਸਾਨੂੰ ਰਲੇਅ ਦੌੜ ਬਾਰੇ ਦੱਸਿਆ ਗਿਆ ਸੀ ਕਿ ਇਹ ਰਲੇਅ ਦੌੜ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਹੋ ਰਹੀ ਹੈ ਅਤੇ ਮੈਂ ਸਵੇਰੇ ਸਵੇਰੇ ਗਰਾਊਂਡ ਵੀ ਜਾਂਦਾ ਸੀ ਤਾਂ ਉੱਥੇ ਵੀ ਮੇਰਾ ਇੱਕ ਕੋਚ ਸੀਗੇ ਉਹਨਾਂ ਨੇ ਵੀ ਮੈਨੂੰ ਦੱਸਿਆ ਰਿਲੇਅ ਦੌੜ ਬਾਰੇ ਕਿ ਤੂੰ ਪਾਰਟੀਸਪੇਟ ਇਸ ਵਿੱਚ ਕਰ ਅਤੇ ਮੈਂ ਇਸ ਵਿੱਚ ਪਾਰਟੀਸਪੇਟ ਕੀਤਾ ਅਤੇ ਮੈਨੂੰ ਵਧੀਆ ਸ਼ੂਜ਼ ਮੈਂ ਬਾਏ ਕੀਤੇ ਵਧੀਆ ਟੀਸ਼ਰਟ ਵਗੈਰਾ ਬਾਏ ਕਰਕੇ ਮੈਂ ਰਿਲੇਅ ਦੌੜ ਵਿੱਚ ਪਾਰਟੀਸਪੇਟ ਕੀਤਾ ਰਿਲੇਅ ਦੌੜ ਵਿੱਚ ਹਰ ਥੋੜ੍ਹੀ ਥਾਂ ਤੋਂ ਬਾਅਦ ਕੋਲਡ ਡਰਿੰਕ ਪਾਣੀ ਵਗੈਰਾ ਮਿਲਦਾ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਲੋਕ ਹਿੱਸੇ ਲੈਂਦੇ ਹਨ ਅਤੇ ਇਸ ਵਿੱਚ ਬਹੁਤ ਜ਼ਿਆਦਾ ਲੰਬੀ ਦੌੜ ਹੁੰਦੀ ਹੈ ਦਸ ਕਿਲੋਮੀਟਰ ਜਾਂ ਸੌਲਾਂ ਕਿਲੋਮੀਟਰ ਦੀ ਰਿਲੇਅ ਦੌੜ ਹੁੰਦੀ ਹੈ ਇਸ ਵਿੱਚ ਇਨਾਮ ਵੀ ਰੱਖਿਆ ਜਾਂਦਾ ਹੈ ਫਸਟ ਪ੍ਰਾਈਜ ਵਿੱਚ ਕਈਆਂ ਨੂੰ ਪੰਜ ਹਜ਼ਾਰ ਕਈਆਂ ਨੂੰ ਕੁਛ ਦਿੱਤਾ ਜਾਂਦਾ ਹੈ ਇਸ ਵਿੱਚ ਕਈ ਤਰ੍ਹਾਂ ਦੇ ਇਨਾਮ ਸਰਟੀਫਿਕੇਟ ਵੀ ਰੱਖੇ ਗਏ ਹੁੰਦੇ ਹਨ